ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਠੀਕ ਏ ਨਵਾਂ ਘਰ ਬਣਿਆ ਤੁਸੀਂ ਤਾਂ ਸਾਰੀ ਫੀਟਿੰਗ ਕਰਵਾਨੀ ਹੈ ਅੱਛਾ ਜੀ ਠੀਕ ਹੈ ਅਤੇ ਤੁਸੀਂ ਠੀਕ ਏ ਜੀ ਠੀਕ ਏ ਤੁਸੀਂ ਆਪਦੇ ਘਰ ਦੀ ਤੁਸੀਂ ਤੁਸੀਂ ਜਿਹਨਾਂ ਕੋਲ ਵੀ ਨੰਬਰ ਚਲੋ ਲਿਆ ਸਾਡਾ ਮੇਰੇ ਆਹ ਨੰਬਰ 'ਤੇ ਵਟਸਐਪ ਵੀ ਚੱਲਦਾ ਤੁਸੀਂ ਇਹਦੇ 'ਤੇ ਆਪਦੇ ਲੋਕੇਸ਼ਨ ਸੈਂਡ ਕਰ ਦਿਓ ਮੈਂ ਆਪਣੇ ਅਸੀਂ ਰੱਖੇ ਇੰਨੇ ਵਰਕਰ ਆਪਣੇ ਜਾਂ ਮੈਂ ਖੁਦ ਦੀ ਆਪ ਆ ਕੇ ਅਸੀਂ ਦੇਖ ਲਾਂਗੇ ਘਰ ਅਤੇ ਫਿਰ ਸਾਰਾ ਜੋ ਜੋ ਸਮਾਨ ਚਾਹੀਦਾ ਹੋਏਗਾ ਅਸੀਂ ਨਾਲ ਬਿਜਲੀ ਦੀ ਤਾਰਾਂ ਹੋਗੀਆ ਜ਼ਰੂਰ ਜੀ ਜ਼ਰੂਰ ਜ਼ਰੂਰ ਤੁਹਾਡਾ ਪੋਰਸ਼ਨ ਡਿਪਲੈਕਸ ਬਣਿਆ ਜਾਂ ਸਿੰਗਲ ਹੈ ਹੀ ਨੀਚੇ ਹੀ ਆ ਪੋਰਸ਼ਨ ਸਿੰਗਲ ਹੀ ਆ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਕਮਰਿਆਂ ਦੀ ਏ ਫਿਰ ਅਸੀਂ ਉਸ ਅਕੋਡਿੰਗ ਸਮਾਨ ਆਪਦਾ ਲੈ ਆਵਾਂਗੇ ਅੱਛਾ ਜੀ ਠੀਕ ਏ ਗੀਜ਼ਰ ਵਗੈਰਾ ਦੀ ਵੀ ਲੋੜ ਏ ਤੁਹਾਨੂੰ ਰਸੋਈ ਵਿੱਚ ਬਾਥਰੂਮ ਵਿੱਚ ਅੱਛਾ ਜੀ ਠੀਕ ਹੈ ਜੀ ਫਿਰ ਤਾਂ ਹੈਲਪਰਸ ਭਾਅ ਜੀ ਸਾਰੇ ਮਤਲਬ ਕਿ ਪੁਆਇੰਟ ਵਗੈਰਾ ਵੀ ਦੇਣੇ ਹੋਣਗੇ ਪਹਿਲੇ ਜਿੱਦਾਂ ਪੁਆਇੰਟ ਵੀ ਗੀਜ਼ਰ ਦਾ ਪੁਆਇੰਟ ਠੀਕ ਏ ਜੀ ਠੀਕ ਹੈ ਜੀ ਤੁਸੀਂ ਅ ਇੱਕ ਵਾਰੀ ਭਾਅ ਜੀ ਸਾਡੀ ਸਾਡੀ ਦੁਕਾਨ 'ਤੇ ਵੀ ਆ ਕੇ ਵੇਖ ਲਓ ਫਿਟਿੰਗ ਦਾ ਤਾਂ ਅਸੀਂ ਕਰ ਦਾਂਗੇ ਕੰਮ ਪਰ ਉਸ ਤੋਂ ਬਾਅਦ ਜਿਹੜੀ ਤੁਸੀਂ ਟਿਊਬ ਲਗਵਾਉਂਣੀਆਂ ਨੇ ਜਾਂ ਦੂਸਰੀਆਂ ਤੁਸੀਂ ਲਾਈਟਾਂ ਲਗਵਾਉਂਦੀਆਂ ਨੇ ਬਾਹਰ ਲੋਬੀ ਆ ਜਾਂ ਪੋਰਚ ਹੈ ਉਹਦੇ ਵਿੱਚ ਅੱਜ ਕੱਲ੍ਹ ਥਰੀ ਜੀ ਲਾਈਟਾਂ ਆਈਆਂ ਹੋਈਆਂ ਨੇ ਜਾਂ ਵਿਦਾਊਟ ਟਿਊਬ ਚਲਦੀਆਂ ਨੇ ਅੱਛਾ ਜੀ ਲੈਂਪ ਵਗੈਰਾ ਠੀਕ ਹੈ ਜੀ ਸਾਡੇ ਕੋਲ ਬੜੇ ਵੱਖਰੇ ਵੱਖਰੇ ਤਰ੍ਹਾਂ ਦੇ ਡਿਜ਼ਾਇਨ ਹੈਗੇ ਨੇ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਸੀਂ ਇੱਕ ਵਾਰੀ ਦੁਕਾਨ 'ਤੇ ਆ ਕੇ ਦੇਖ ਕੇ ਜਾਓ ਹਾਂਜੀ ਹਾਂਜੀ ਹਾਂਜੀ ਅਸੀਂ ਸੋਲਰ ਲਾਈਟਾਂ ਦਾ ਵੀ ਨਾਲ ਕੰਮ ਕੀਤਾ ਹੋਇਆ ਅਤੇ ਜਿਹੜੀਆ ਜਿਹੜੀਆਂ ਦੂਜੀ ਵੀ ਬਿਜਲੀ 'ਤੇ ਵੀ ਲਾਈਟਾਂ ਨੇ ਉਹਦੇ ਨਾਲ ਯੂਨਿਟ ਘੱਟ ਬਲਦੇ ਹਨ ਪਰ ਉਹਨਾਂ ਦੀ ਪੂਰੀ ਰੋਸ਼ਨੀ ਹੈ ਅਤੇ ਇੱਕ ਉਹਨਾਂ ਦੇ ਪੂਰੇ ਸਾਲ ਦੀ ਵਰੰਟੀ ਦਾ ਵੀ ਹੈ ਤੁਸੀਂ ਬੇਫਿਕਰ ਹੋ ਕੇ ਸਾਨੂੰ ਸੇਵਾ ਦਾ ਮੌਕਾ ਦਿਓ ਸਾਨੂੰ ਬੜਾ ਅੱਛਾ ਰਹੇਗਾ ਕੀ ਕੋਈ ਸ਼ੂਜ ਦੀ ਵੀ ਉਹਨਾਂ ਦੀ ਗਰੰਟੀ ਹੈ ਕੀ ਲਾਈਟਾਂ ਦੇ ਉੱਤੇ ਅਸੀਂ ਡੇਟ ਪੂਰੀ ਮੈਸ਼ਨ ਕਰ ਕੇ ਦਿੰਦੇ ਹਾਂ ਕਿ ਜੇਕਰ ਉਹ ਪੂਰੇ ਸਾਲ ਤੋਂ ਪਹਿਲਾਂ ਖਰਾਬ ਹੋ ਜਾਂਦੀਆਂ ਨੇ ਤਾਂ ਉਹ ਐਕਸਚੇਂਜ ਕਰਕੇ ਦਿੰਦੇ ਹਾਂ ਅਸੀਂ ਆਪਣੀ ਲੋਹੇ ਦੀ ਤਾਰਾਂ ਦੇ ਉੱਤੇ ਨਾਲ ਪਲਾਸਟਿਕ ਦਾ ਪੂਰਾ ਖੋਲ੍ਹ ਚੜਿਆ ਹੋਇਆ ਹੁੰਦਾ ਜਿਹਦੇ ਨਾਲ ਤਾਰਾ ਗਲਦੀਆਂ ਨਹੀਂ ਇਹ ਅੱਜ ਕੱਲ੍ਹ ਪਲਾਸਟਿਕ ਵੀ ਚਾਈਨਾ ਤੋਂ ਆਉਂਦਾ ਭਾਅ ਜੀ ਕਿ ਉਹ ਦੂਸਰੇ ਮਟੀਰੀਅਲ ਦਾ ਕਿ ਇਹ ਸੀਮਿੰਟ ਦੇ ਵਿੱਚ ਜੇਕਰ ਕੋਈ ਸਿਲਨ ਹੈ ਜਾਂ ਕੁਛ ਹੈ ਫਿਰ ਇਹ ਤਾਰਾਂ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਹੁੰਦਾ ਦਸ ਸਾਲ ਦੀ ਗਰੰਟੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਨਹੀਂ ਨਹੀਂ ਜੀ ਤੁਸੀਂ ਬੇਫਿਕਰ ਰਹੋ ਜੀ ਅਸੀਂ ਇਸ ਸ਼ਹਿਰ ਵਿਚ ਹੀ ਬੈਠੇ ਹਾਂ ਤੁਸੀਂ ਜ਼ਰੂਰ ਕੰਮ ਕਰਵਾ ਕੇ ਦੇਖੋ

ਜ਼ਰੂਰ ਜੀ ਤੁਸੀਂ ਸਾਨੂੰ ਬਸ ਲੋਕੇਸ਼ਨ ਐਡਰੈਸ ਸੈਂਡ ਕਰ ਦਿਓ ਆਪਣਾ ਅਸੀਂ ਅੱਜ ਸ਼ਾਮ ਨੂੰ ਹੀ ਫਿਰ ਸਾਰਾ ਸਮਾਨ ਪਹੁੰਚਾ ਦਾਂਗੇ ਕੱਲ੍ਹ ਤੱਕ 'ਤੇ ਕੰਮ ਸ਼ੁਰੂ ਹੋ ਜਾਏਗਾ ਤੁਹਾਡਾ ਠੀਕ ਹੈ ਜੀ ਧੰਨਵਾਦ